ਬਿਜਲੀ ਸਾਡੇ ਜੀਵਨ ਦੀ ਇੱਕ ਖਾਸ ਜ਼ਰੂਰਤ ਬਣ ਚੁੱਕੀ ਹੈ ਪਰ ਇਹ ਗਲਤ ਵਰਤੋਂ ਜਾਂ ਲਾਪਰਵਾਹੀ ਕਰਕੇ ਖਤਰਨਾਕ ਵੀ ਹੋ ਜਾਂਦੀ ਹੈ ਬਿਜਲੀ ਦਾ ਝਟਕਾ ਲੱਗਣਾ ਅੱਗ ਲੱਗਣਾ ਸ਼ੋਰਟ ਸਰਕਿਟ ਹੋਣਾ ਅਤੇ ਜ਼ਿਆਦਾ ਵੋਲਟੇਜ ਕਰਕੇ ਗੁੱਝੀਆਂ ਸੱਟਾਂ ਜਾਂ ਮੌਤ ਵੀ ਹੋ ਸਕਦੀ ਹੈ ਬਿਜਲੀ ਨਾਲ ਜੁੜੇ ਸਭ ਤੋਂ ਵੱਡੇ ਖਤਰੇ ਵਿੱਚ ਗਿੱਲੀ ਥਾਂ ਜਾਂ ਖੁੱਲ੍ਹੀਆਂ ਤਾਰਾਂ ਨੂੰ ਹੱਥ ਲਾਉਣਾ ਨਾ ਠੀਕ ਹੋਈ ਤਾਰਾਂ ਨੂੰ ਜਾਂ ਅੱਧੀ ਇੰਸੂਲੇਸ਼ਨ ਵਾਲੀਆਂ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਹਨ ਇਹਨਾਂ ਤੋਂ ਬਚਣ ਲਈ ਸਾਨੂੰ ਕਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਜਿਵੇਂ ਗਿੱਲੇ ਹੱਥਾਂ ਦੇ ਨਾਲ ਕਿਸੇ ਬਿਜਲੀ ਤਾਰ ਸਵਿਚ ਜਾਂ ਹੋਰ ਅਪਲਾਂਇਸਿਸ ਨੂੰ ਨਾ ਛੂਹੋ ਟੁੱਟੇ ਹੋਏ ਤਾਰਾਂ ਨੂੰ ਤੁਰੰਤ ਬਦਲੋ ਅਤੇ ਜ਼ਿਆਦਾ ਵੋਲਟੇਜ ਵਾਲੀ ਜਗ੍ਹਾ 'ਤੇ ਚੇਤਾਵਨੀ ਵਾਲੇ ਸਾਈਨ ਬੋਰਡ ਲਗਾਓ ਘਰ ਅਤੇ ਕੰਮ ਦੀ ਥਾਂ 'ਤੇ ਵਧੀਆ ਕੁਆਲਿਟੀ ਵਾਲੇ ਇਲੈਕਟਰੀਕਲ ਉਪਕਰਨ ਵਰਤਣੇ ਚਾਹੀਦੇ ਹਨ ਜੋ ਅੱਗ ਲੱਗਣ ਜਾਂ ਝਟਕਿਆਂ ਤੋਂ ਬਚਣ ਲਈ ਸੁਰੱਖਿਅਤ ਹੋਣ ਘਰਾਂ ਵਿੱਚ ਸਾਨੂੰ ਅਰਥਿੰਗ ਕਰਾਉਣੀ ਚਾਹੀਦੀ ਹੈ ਜਿਸ ਕਰਕੇ ਸਾਨੂੰ ਬਿਜਲੀ ਦਾ ਝਟਕਾ ਲੱਗਣ ਦਾ ਖਤਰਾ ਘੱਟ ਜਾਂਦਾ ਹੈ ਬਿਜਲੀ ਦੇ ਖੰਭਿਆਂ ਜਾਂ ਖੁੱਲ੍ਹੀਆਂ ਤਾਰਾਂ ਦੇ ਨੇੜੇ ਜਾਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਬੱਚਿਆਂ ਨੂੰ ਬਿਜਲੀ ਦੇ ਉਪਕਰਨਾਂ ਨਾਲ ਖੇਡਣ ਤੋਂ ਰੋਕਣਾ ਚਾਹੀਦਾ ਹੈ ਹਮੇਸ਼ਾ ਇੱਕ ਤਕਨੀਕੀ ਵਿਅਕਤੀ ਤੋਂ ਹੀ ਬਿਜਲੀ ਦਾ ਕੰਮ ਕਰਾਉਣਾ ਚਾਹੀਦਾ ਹੈ ਇਸ ਤਰ੍ਹਾਂ ਜੇਕਰ ਅਸੀਂ ਬਿਜਲੀ ਦੀ ਵਰਤੋਂ ਧਿਆਨ ਦੇ ਨਾਲ ਕਰੀਏ ਅਤੇ ਸਾਵਧਾਨੀ ਵਰਤੀਏ ਤਾਂ ਇਸ ਨੂੰ ਅਸੀਂ ਆਸਾਨੀ ਸੁਰੱਖਿਆ ਅਤੇ ਸੁਵਿਧਾ ਦੇ ਨਾਲ ਯੂਜ ਕਰ ਸਕਦੇ ਹਾਂ ਅਤੇ ਇਸ ਤੋਂ ਸਾਨੂੰ ਕੋਈ ਹੋਰ ਖਤਰਾ ਨਹੀਂ ਹੋ ਪਾਵੇਗਾ